ਹਾਂ ਡੋਕਟਰ ਸਾਹਿਬ ਗੱਲ ਕਰ ਰਹੇ ਜੀ ਹਾਂਜੀ ਵੀਰੇ ਉਹ ਮੈਂ ਨਾ ਆਹਾ ਧਨੋਟ ਪਿੰਡ ਤੋਂ ਗੱਲ ਕਰ ਰਿਹਾ ਸੀਗਾ ਸਰ ਧਨੋਟ ਧਨੋਟ ਭਾਅ ਜੀ ਆਪਣੇ ਇੱਧਰ ਲੁਧਿਆਣੇ ਤੋਂ ਅੱਗੇ ਜਾਉਂਗੇ ਜਸਪਾਲ ਬਾਂਗਰ ਤੋਂ ਨਾਲ਼ ਹੀ ਅੱਗੇ ਜਾ ਕੇ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਮੈਂ ਕਹਿਣਾ ਸੀਗਾ ਸਾਡੇ ਨਾ ਇੱਥੇ ਸਰ ਪਿੰਡ 'ਚ ਜੁਆਕਾਂ ਨੂੰ ਜ਼ੁਖਾਮ ਬਹੁਤ ਹੋ ਰਿਹਾ ਅਤੇ ਵੀਰੇ ਇੱਕ ਸਰ ਉਹ ਦੇ ਨਾਲ਼ ਮੈਨੂੰ ਵੀ ਥੋੜ੍ਹਾ ਬਹੁਤ ਹੋ ਰਿਹਾ ਗਾ ਹੁਣ ਮਤਲਬ ਤੁਸੀਂ ਕਹਿ ਲਓ ਆਹ ਫਲੂ ਨਹੀਂ ਫੈਲਿਆ ਹੋਇਆ ਓ ਓ ਚੱਕਰ 'ਚ ਬਿਮਾਰ ਆ ਹੋਈ ਹੈ ਅਤੇ ਸਰ ਦੱਸੁੰਗੇ ਕਿ ਇਹਦਾ ਕੋਈ ਠੋਸ ਇਲਾਜ ਜਿਵੇਂ ਪ੍ਰੀਕੋਸ਼ਨ ਸਰ ਅਸੀਂ ਚਾਰ ਜਣੇ ਹਾਂ ਮੈਂ ਮੇਰੇ ਮਾਤਾ ਜੀ ਮੇਰੇ ਡੈਡੀ ਅਤੇ ਮੇਰੀ ਭੈਣ ਜੀ ਮੱਲੇ 'ਚ ਰਹਿੰਦੇ ਹਾਂ ਮੱਲੇ 'ਚ ਮੱਲੇ 'ਚ ਜੀ ਦੇਖੋ ਚਾਰ ਮਕਾਨ ਨੇ ਸਰ ਮਤਲਬ ਚਾਰ ਮਕਾਨ 'ਚ ਦੇਖ ਲਓ ਚਾਰ ਚਾਰ ਜਣੇ ਨੇ ਸੌਲ੍ਹਾਂ ਸਤਾਰ੍ਹਾਂ ਸਾਡੇ ਘਰ ਤੋਂ ਨਾ ਥੋੜ੍ਹਾ ਜਿਹਾ ਅੱਗੇ ਪੰਜ ਮਿੰਟ ਰਾਹ ਤੋਂ ਅੱਗੇ ਨਾ ਟੋਬਾ ਪੈਂਦਾ ਪਾਣੀ ਤਾਂ ਭਰਿਆ ਹੀ ਰਹਿੰਦਾ ਸਰ ਉਹ ਦੇ ਤਿੰਨ ਸੌ ਪੈਂਹਟ ਦਿਨ ਪੂਰੇ ਸਾਰੇ ਸਾਲ ਖੜ੍ਹਾ ਹੀ ਪਿਆ ਪਾਣੀ ਤਾਂ ਖੜ੍ਹਾ ਹੀ ਆ ਹਾਂਜੀ ਹਾਂਜੀ ਸਰ ਉਹ ਵਿੱਚ ਕਦੇ ਮੱਝਾਂ ਮੁਝਾਂ ਲੰਘ ਦੀ ਦਾ ਲੰਘ ਜਾਂਦੀਆਂ ਨੇ ਵਿੱਚ ਐਈਂ ਸਾਰੇ ਡੰਗਰ ਬੱਛੇ ਸਾਰੇ ਫਲੂ ਫਲੂ ਸਰ ਫਲੂ ਫੈਲਿਆ ਹੋਇਆ ਸਿਰ ਦੁਖਣ ਲੱਗ ਜਾਂਦਾ ਹੱਥ ਕੰਬਣ ਲੱਗ ਜਾਂਦੇ ਆ ਛਿੱਕਾਂ ਆਉਂਦੀਆਂ ਨੇ ਹਜੇ ਹਜੇ ਸਰ ਪਰਿਵਾਰ 'ਚ ਤਾਂ ਇੰਨਾਂ ਹੋਇਆ ਨਹੀਂ ਮੈਨੂੰ ਹੋਇਆ ਅਤੇ ਨਾਲ਼ ਦੇ ਘਰਾਂ ਦੇ ਵਿੱਚ ਹੋ ਰਿਹਾ ਹਾਂਜੀ ਹਾਂਜੀ ਅੱਛਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਠੀਕ ਹੈ ਸਰ ਹਾਂਜੀ ਹਾਂਜੀ ਸਰ ਥੋੜ੍ਹਾ ਜਿਹਾ ਦੱਸ ਦਿਓ ਮਤਲਬ ਖਾਣ ਪੀਣ ਦਾ ਕਿਵੇਂ ਕਰੀਏ ਠੀਕ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਨਿਰਲੇ ਕਾਲਜੇ ਤਾਂ ਨਹੀਂ ਕੋਈ ਸਰ ਠੀਕ ਹੈ ਸਰ ਹਾਂਜੀ ਠੀਕ ਹੈ ਸਰ ਠੀਕ ਹੈ ਸਰ ਹਾਂਜੀ ਸਰ ਰੋਟੀ ਖਾਧੀ ਸੀ ਸਰ ਹੋ ਪਾਲਕ ਮੇਥੀ ਦੀ ਭੁਰਜੀ ਬਣੀ ਸੀ ਸਰ ਨਹੀਂ ਸਰ ਲੈ ਕੇ ਤਾਂ ਬਜ਼ਾਰੋਂ ਆਏ ਸੀ ਪਰ ਸਰ ਪਤਾ ਨਹੀਂ ਕੀ ਪ੍ਰੋਬਲਮ ਹੋਈ ਸਰ ਬੜਾ ਡਰਿਆ ਹੋਇਆਂ ਸਰ ਉਹ ਦਰਅਸਲ ਨਾ ਘਰਦੇ ਵੀ ਕਹਿ ਰਹੇ ਫੈਲ ਰਿਹਾ ਫਲੂ ਸਰ ਹਾਂਜੀ ਹਾਂਜੀ ਸਰ ਠੀਕ ਹੈ ਸਰ ਮੈਂ ਸਰ ਹਾਂਜੀ ਹਾਂਜੀ ਮੈਂ ਸਰਪੰਚ ਨਾਲ਼ ਗੱਲ ਕਰੂੰਗਾ ਸਰ ਕਿ ਇਹਦਾ ਕੁਛ ਹੀਲਾ ਹੂਲਾ ਹਾਂਜੀ ਹਾਂਜੀ ਸਰ ਸਰ ਕਿੱਥੇ ਹੈ ਠੀਕ ਹੈ ਸਰ ਅਤੇ ਕਿੰਨੇ ਕ ਵਜੇ ਆ ਜਾਨੇ ਤੁਸੀਂ ਸਰ ਕਿੰਨੇ ਤੋਂ ਕਿੰਨੇ ਹੁੰਨੇ ਆ ਠੀਕ ਹੈ ਸਰ ਹਾਂਜੀ ਥੈਂਕ ਯੂ ਸਰ ਓਕੇ ਸਰ